ਹੈਲੋ ਹਾਂਜੀ ਮੁਕਤਸਰ ਤੋਂ ਬੋਲਦੇ ਜੀ ਹਾਂਜੀ ਮੈਂ ਜਲੰਧਰ ਤੋਂ ਬੋਲ ਰਿਹਾ ਜੀ ਮੈਂ ਤੁਹਾਨੂੰ ਤੁਹਾਡੇ ਤੋਂ ਮੁਕਤਸਰ ਦੇ ਮਾਘੀ ਮੇਲੇ ਬਾਰੇ ਕੁਝ ਜਾਣਕਾਰੀ ਲੈਣੀ ਸੀ

ਹਾਂਜੀ ਅਤੇ ਇਸ ਦੇ ਪਿੱਛੇ ਇਸ ਦੀ ਕਹਾਣੀ ਕੀ ਹੈ ਪੂਰੀ ਠੀਕ ਹੈ ਜੀ

ਹਾਂਜੀ

ਹਾਂਜੀ ਹਾਂਜੀ

ਚਲੋ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਐਹੈਚਲੋ ਫਿਰ ਅਸੀਂ ਆਉਣੇ ਹਾਂ

ਓਕ ਹਾਂਜੀ ਓਕੇ